ਪਹਿਲੀ ਵਾਰ ਮੈਨੂੰ ਗਾਉਣ ਦੇ ਲਈ ਸਾਡੇ ਸਕੂਲ ਦੇ ਵਿੱਚ ਜਦੋਂ ਕੀਰਤਨ ਕਰਨ ਦੇ ਲਈ ਗਰੁੱਪ ਬਣਿਆ ਤਾਂ ਉੱਥੇ ਮੈਨੂੰ ਗਾਉਣ ਦਾ ਮੌਕਾ ਮਿਲਿਆ ਅਸੀਂ ਹਾਰਮੋਨੀਅਮ ਤਬਲੇ ਦੇ ਨਾਲ ਸ਼ਬਦ ਗਾਉਂਦੇ ਸੀਗੇ ਇਸ ਤਰ੍ਹਾਂ ਹੀ ਫਿਰ ਜਦੋਂ ਸਾਨੂੰ ਫਰੀ ਟਾਈਮ ਮਿਲਦਾ ਤਾਂ ਅਸੀਂ ਸ਼ਬਦ ਤੋਂ ਬਾਅਦ ਸ਼ਬਦ ਦੇ ਰਿਆਜ਼ ਤੋਂ ਬਾਅਦ ਕਈ ਗਾਣੇ ਗਾਉਣੇ ਸ਼ੁਰੂ ਕਰ ਦਿੱਤੇ ਉਹ 'ਚ ਮੇਰੇ ਜਿਹੜੇ ਟੀਚਰਜ਼ ਸੀਗੇ ਉਹਨਾਂ ਨੇ ਵੀ ਮੈਨੂੰ ਕਾਫ਼ੀ ਸਾਰੀਆਂ ਚੀਜ਼ਾਂ ਸਿਖਾਈਆਂ ਜਿਨ੍ਹਾਂ ਦੇ ਨਾਲ ਮੈਨੂੰ ਗਾਉਣਾ ਜਿਹੜਾ ਹੈ ਉਹ ਵਧੀਆ ਲੱਗਣ ਲੱਗਿਆ ਫਿਰ ਘਰ ਆ ਕੇ ਵੀ ਮੈਂ ਕੋਈ ਨਾ ਕੋਈ ਗਾਣਾ ਜਿਹੜਾ ਸੀ ਉਹ ਗੁਣਗੁਣਾਉਂਦੀ ਰਹਿਣਾ ਜਦੋਂ ਵੀ ਕੋਈ ਕੰਮ ਕਰਦੀ ਹੋਣਾ ਉਹਦੇ ਨਾਲ ਨਾਲ ਗਾਣਾ ਗੁਣਗੁਣਾਉਣਾ ਮੇਰੀ ਆਦਤ ਬਣ ਚੁੱਕੀ ਸੀ ਫਿਰ ਉਸ ਤੋਂ ਬਾਅਦ ਜਦੋਂ ਮੈਂ ਥੋੜ੍ਹੀ ਵੱਡੀ ਹੋਈ ਤਾਂ ਮੈਨੂੰ ਸਕੂਲ ਦੇ ਵਿੱਚੋਂ ਹੀ ਸਾਡੇ ਇੰਟਰ ਸਕੂਲ ਕੋਂਪੀਟੀਸ਼ਨ ਦੇ ਲਈ ਹੋਰ ਸਕੂਲਸ ਦੇ ਵਿੱਚ ਜਾ ਕੇ ਗਾਉਣ ਦਾ ਮੌਕਾ ਮਿਲਿਆ ਉੱਥੇ ਵੀ ਇੱਕ ਵਾਰ ਇਸ ਤਰ੍ਹਾਂ ਹੋਇਆ ਕਿ ਮੇਰਾ ਜਿਹੜਾ ਮਾਈਕ ਸੀਗਾ ਗਾਉਂਦੀ ਗਾਉਂਦੀ ਦਾ ਉਹ ਬੰਦ ਹੋ ਗਿਆ ਪਰ ਮੈਂ ਫਿਰ ਵੀ ਗਾਉਣਾ ਰੁਕੀ ਨਹੀਂ ਅਤੇ ਆਪਣਾ ਗਾਣਾ ਜਿਹੜਾ ਸੀ ਉਸਨੂੰ ਪੂਰਾ ਕੀਤਾ ਉੱਥੇ ਜਿਹੜੇ ਓਡੀਐਂਸ ਮੌਜੂਦ ਸੀਗੀ ਉਹਨੇ ਵੀ ਮੇਰਾ ਬੜਾ ਸਾਥ ਦਿੱਤਾ ਮਤਲਬ ਬਿਲਕੁਲ ਵੀ ਮੇਰਾ ਹੌਂਸਲਾ ਡਗਮਗਾਉਣ ਨਹੀਂ ਦਿੱਤਾ ਸਭ ਨੇ ਮੈਨੂੰ ਬੜੀ ਸ਼ਾਬਾਸ਼ੀ ਦਿੱਤੀ ਅਤੇ ਉੱਥੋਂ ਮੈਂ ਫਸਟ ਪੁਜ਼ੀਸ਼ਨ ਜਿਹੜੀ ਸੀ ਉਹ ਹਾਸਿਲ ਕੀਤੀ ਫਿਰ ਅੱਜ ਵੀ ਇਵੇਂ ਹੀ ਹੁੰਦਾ ਕਿ ਮੈਂ ਜਿੰਨੀ ਮਰਜ਼ੀ ਪਰੇਸ਼ਾਨ ਹੋਵਾਂ ਜਾਂ ਕੋਈ ਵੀ ਚੀਜ਼ ਮੈਨੂੰ ਤੰਗ ਕਰਦੀ ਹੋਵੇ ਮਤਲਬ ਕਹਿ ਲਓ ਕਿ ਮੇਰੇ ਗੀਤ ਜਿਹੜੇ ਆ ਉਹ ਮੇਰੀ ਲਾਈਫ ਦਾ ਇੱਕ ਹਿੱਸਾ ਬਣ ਚੁੱਕੇ ਆ ਮੈਂ ਠੀਕ ਨਾ ਮਹਿਸੂਸ ਕਰਦੀ ਹੋਵਾਂ ਜਾਂ ਖੁਸ਼ ਹੋਵਾਂ ਸੋ ਮੈਂ ਗਾਣੇ ਜ਼ਰੂਰ ਸੁਣਦੀ ਹਾਂ ਗਾਉਂਦੀ ਹਾਂ